ਪੰਜਾਬ ਵਿੱਚ ਸਰਕਾਰੀ ਸਿਹਤ ਸਕੀਮਾਂ ਬਹੁਤ ਹੀ ਜ਼ਿਆਦਾ ਹਨ ਪਰ ਜੋ ਨਾ ਜਿੰਨਾ ਕਰ ਮੈਂ ਜਾਣੂ ਹਾਂ ਉਹਨਾਂ ਵਿੱਚ ਕਈ ਐਸੀਆਂ ਸਕੀਮਾਂ ਹਨ ਜਿਹਨਾਂ ਦਾ ਮੈਂ ਲਾਭ ਲੈ ਚੁੱਕਿਆ ਹਾਂ ਜਿਵੇਂ ਕਿ ਆਯੁਸ਼ਮਾਨ ਕਾਰਡ ਸਕੀਮ ਇਸ ਵਿੱਚ ਮੇਰੇ ਮਾਤਾ ਜੀ ਬਿਮਾਰ ਹੋਏ ਸਨ ਜਿਸ ਵਿੱਚ ਆਯੁਸ਼ਮਾਨ ਕਾਰਡ ਦੇ ਰਾਹੀਂ ਮੈਂ ਉਹਨਾਂ ਦਾ ਇਲਾਜ ਕਰਵਾਇਆ ਸੀ ਇਹਨਾਂ ਦੇ ਇਲਾਜ ਮੁਫਤ ਹੋਇਆ ਸੀ ਮੇਰਾ ਦਵਾਈ 'ਤੇ ਟੈਸਟਾਂ ਦਾ ਖਰਚਾ ਮੈਨੂੰ ਦੇਣਾ ਪਿਆ ਸੀ ਬਾਕੀ ਡੋਕਟਰ ਦੀ ਫੀਸ ਅਤੇ ਟਰੀਟਮੈਂਟ ਫਰੀ ਹੋਇਆ ਸੀ ਉਸ ਤੋਂ ਇਲਾਵਾ ਬਾਹਰੋਂ ਜਿਹੜੇ ਟੈਸਟ ਹੋਏ ਉਸ ਦਾ ਵੀ ਪੈਸੇ ਮੈਂ ਦਿੱਤੇ ਸੀ ਬਾਕੀ ਪੰਜਾਬ ਵਿੱਚ ਸ਼ਗਨ ਸਕੀਮ ਹੋ ਗਈ ਸ਼ਗਨ ਸਕੀਮ ਵੀ ਬੜੀਆ ਸਕੀਮ ਕੱਢੀ ਹੈ ਪੰਜਾਬ ਸਰਕਾਰ ਨੇ ਜਿਸ ਵਿੱਚ ਬੱਚਿਆਂ ਨੂੰ ਗਰੀਬ ਘਰ ਦੇ ਬੱਚਿਆਂ ਨੂੰ ਵਿਆਹ 'ਤੇ ਲੜਕੀਆਂ ਕੁੜੀਆਂ ਨੂੰ ਪੰਜਾਬ ਸਰਕਾਰ ਦੁਆਰਾ ਸ਼ਗਨ ਸਕੀਮ ਰਾਹੀਂ ਬਣਦੀ ਰਕਮ ਅਦਾ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਰੁਜ਼ਗਾਰ ਸਕੀਮਾਂ ਹੋਰ ਵੀ ਕਈ ਤਰ੍ਹਾਂ ਦੀਆਂ ਵੱਖ ਵੱਖ ਸਕੀਮਾਂ ਜਿਹਨਾਂ ਵਿੱਚ ਪੰਜਾਬ ਵਿੱਚ ਲੋਕ ਕਾਫੀ ਖੁਸ਼ਹਾਲ ਹਨ ਇਸ ਕਰਕੇ ਮੈਂ ਪੰਜਾਬ 'ਤੇ ਮਾਣ ਕਰਦਾ ਹਾਂ ਅਤੇ ਮੈਂ ਆਪਣੇ ਆਪ ਨੂੰ ਪੰਜਾਬੀ ਕਹਾਉਂਦਾ ਹਾਂ